ਹੁਨ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਬੜੇ ਬਦਲਾਅ ਆਏ ਆਂ ਪਹਿਲਾਂ ਵਰਗੇ ਨਹੀਂ ਰਹੀ ਪਹਿਲਾਂ ਕੀ ਸੀ ਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਸੀ ਹੁਣ ਜਿਹੜਾ ਹੈ ਕਿ ਬੜੇ ਚੇਂਜਿਸ ਆਏ ਨੇ ਬੜੇ ਹੀ ਬਦਲਾਅ ਕੀਤੇ ਨੇ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਇਹਨੇ ਸਕੂਲਾਂ ਵੱਲ ਪੂਰਾ ਧਿਆਨ ਦਿੱਤਾ ਹੁਣ ਇਹ ਕਿ ਪੜ੍ਹੇ ਲਿਖੇ ਅਧਿਆਪਕ ਰੱਖੇ ਜਾਂਦੇ ਨੇ ਉਹਨਾਂ ਦੀ ਟੀਚਿੰਗ ਨੂੰ ਇਫੈਕਟਿਵ ਬਣਾਉਣ ਲਈ ਉਹਨਾਂ ਨੂੰ ਇੰਟਰਨਸ਼ਿਪ ਲਗਾਈ ਜਾਂਦੀ ਹੈ ਜਦੋਂ ਅਧਿਆਪਕ ਟ੍ਰੇਨਡ ਹੋਣਗੇ ਤਾਂ ਉਹ ਬੱਚਿਆਂ ਨੂੰ ਅੱਗੋਂ ਚੰਗੀ ਤਰ੍ਹਾਂ ਪੜ੍ਹਾ ਪਾਉਣਗੇ ਇਹ ਕਿ ਟੀਚਰਾਂ ਨੂੰ ਪ੍ਰੋਤਸਾਹਨ ਕਰਨ ਲਈ ਉਹਨਾਂ ਨੂੰ ਟਾਈਮ 'ਤੇ ਤੇ ਕਹਿ ਲਓ ਕਿ ਇੱਕ ਸਾਲ ਬਾਅਦ ਇੰਨਸੈਂਨਟਿਵ ਵਾਲੀ ਸੈਲਰੀ ਵੀ ਦਿੱਤੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਪ੍ਰੋਤਸਾਹਨ ਮਿਲੇ ਅਧਿਆਪਕਾਂ ਦੀਆਂ ਯੂਨੀਅਨਾਂ ਬਣ ਗਈਆਂ ਨੇ ਜਿਨ੍ਹਾਂ ਨੇ ਪੱਕੀਆਂ ਨੌਕਰੀਆਂ ਨਾਲ ਉਹਨਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੁਣ ਤਾਂ ਬਹੁਤ ਫਰਕ ਆ ਗਿਆ ਪਹਿਲਾਂ ਵਰਗੀਆਂ ਗੱਲਾਂ ਤਾਂ ਹੁਣ ਖਤਮ ਹੋ ਗਈਆਂ ਹੁਣ ਪਹਿਲਾਂ ਵਰਗੇ ਸਰਕਾਰੀ ਸਕੂਲ ਰਹੇ ਹੀ ਨਹੀਂ ਹੁਣ ਸਾਰੇ ਸਕੂਲਾਂ ਨੂੰ ਦੇਖੋ ਪੰਜਾਬ ਸਰਕਾਰ ਨੇ ਵਧੀਆ ਬਣਾ ਦਿੱਤਾ ਅਤੇ ਅਧਿਆਪਕਾਂ ਦੀ ਘਾਟ ਨੂੰ ਵੀ ਖਤਮ ਕੀਤਾ ਹੈ ਪਿਛਲੇ ਸਾਲ ਬਹੁਤ ਸਾਰੀਆਂ ਭਰਤੀਆਂ ਹੋਈਆਂ ਨੇ ਅਧਿਆਪਕਾਂ ਦੀਆਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਕੇ ਉਹਨਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਗਿਆ ਹੈ ਸਿੱਖਿਆ ਪ੍ਰਣਾਲੀ ਨੂੰ ਤਾਂ ਕਿ ਕਹਿ ਲਓ ਕਿ ਜਿੰਨੇ ਇਫੈਕਟਿਵ ਟੀਚਿੰਗ ਪੁਰਾਣੇ ਅਧਿਆਪਕ ਜਾਂ ਜਿਨ੍ਹਾਂ ਨੂੰ ਟ੍ਰੇਨਿੰਗਾਂ ਮਿਲ ਗਈਆਂ ਨੇ ਉਹ ਕਰ ਸਕਦੇ ਨੇ ਉਹ ਇਕਦਮ ਫਰੈਸ਼ਰ ਬੰਦਾ ਨਹੀਂ ਕਰ ਸਕਦਾ ਇਸ ਕਰਕੇ ਹੁਣ ਤਾਂ ਬਹੁਤ ਸੁਧਾਰ ਆਇਆ